ਹੈਲੋ ਭਾਅ ਜੀ ਸਵਿਗੀ ਏਜੰਟ ਬੋਲਦੇ ਜੇ ਅਤੇ ਮੈਂ ਨਾ ਅ ਔਡਰ ਦੇਣਾ ਸੀਗਾ ਮੇਰੇ ਘਰ ਪਾਰਟੀ ਸੀਗੀ ਮੇਰੇ ਫਰੈਂਡ ਦਾ ਬੱਡੇ ਸੀਗਾ ਅਤੇ ਉਹਦੀ ਪਾਰਟੀ ਸੀਗੀ ਤਾਂ ਤੁਹਾਡੇ ਇੱਥੇ ਮਤਲਬ ਖਾਣ ਨੂੰ ਕੀ ਮਿਲਦਾ ਓਕੇ ਅਤੇ ਤੁਸੀਂ ਫਿਰ ਪੀਜ਼ਾ ਅਤੇ ਬਰਗਰਸ ਕਰ ਦਿਓ ਮਤਲਬ ਪ ਪੰਜ ਰੈਗੂਲਰ ਪੀਜ਼ਾਸ ਕਰ ਦਿਓ ਅਤੇ ਪੰਦਰਾਂ ਬਰਗਰ ਕਰ ਦਿਓ ਠੀਕ ਹੈ ਅਤੇ ਤੁਹਾਡੇ ਇੱਥੇ ਖਾਣ ਪੀਣ ਪੀਣ ਵਾਲੀਆਂ ਕਿਹੜੀਆਂ ਹੋਣਗੀਆਂ ਡਰਿੰਕਸ ਅਤੇ ਹੁਣ ਕਿਹੜੀਆਂ ਕਿਹੜੀਆਂ ਹੋਣਗੀਆਂ ਕੋਕ ਹੋਏਗੀ ਯੂਸ ਹੋਏਗਾ ਠੀਕ ਹੈ ਅਤੇ ਕੌਫੀ ਹੋਏਗੀ ਅੱਛਾ ਕੌਫੀ ਹੋਏਗੀ ਅਤੇ ਕੌਫੀ ਕਿੰਨੇ ਦੀ ਹੋਏਗੀ ਇੱਕ ਓਕੇ ਅਤੇ ਤੁਸੀਂ ਫਿਰ ਪੰਦਰਾਂ ਕੌਫੀਸ ਕਰ ਦਿਓ ਕੋਲਡ ਕੌਫੀਸ ਕਰ ਦਿਓ ਪੰਦਰਾਂ ਅਤੇ ਥੋੜ੍ਹਾ ਜਲਦੀ ਕਰ ਦਿਓ ਕਿਉਂਕਿ ਫਿਰ ਗੈਸਟ ਆਏ ਹੋਏ ਨੇ ਤਾਂ ਫਿਰ ਉਹਨਾਂ ਨੂੰ ਫਿਰ ਇਹ ਨਾ ਹੋਵੇ ਕਿ ਸਾਡਾ ਡਰਿੰਕਸ ਦੇ ਚੱਕਰ 'ਚ ਉਹ ਵੀ ਲੇਟ ਹੋ ਜਾਣ ਅਤੇ ਤੁਸੀਂ ਦੋ ਹੌਟ ਕੌਫੀਸ ਵੀ ਕਰ ਦਿਓ ਠੀਕ ਹੈ ਅਤੇ ਨਾਲ ਤੁਸੀਂ ਕਰ ਦਿਓ ਫਰੈਂਚ ਫਰਾਈਜ ਠੀਕ ਹੈ ਕਿੰਨਾ ਕੁ ਟਾਈਮ ਲੱਗੇਗਾ ਓਕੇ ਅਤੇ ਤੁਸੀਂ ਭੇਜ ਦਿਓ ਇੱਧਰ ਖਾਲਸਾ ਕੋਲਜ ਵਾਲੀ ਗਲੀ ਆ ਉਹਦੇ ਅੰਦਰ ਜਾ ਕੇ ਕਲੋਥਸ ਵਾਲੀ ਦੁਕਾਨ ਹੈ ਉਹਦੇ ਲਾਗੇ ਇੱਕ ਸ਼ੋ ਮਤਲਬ ਉਹਦੇ ਲਾਗੇ ਇੱਕ ਘਰ ਹੈਗਾ ਉੱਥੇ ਡਿਲੀਵਰ ਕਰਨਾ ਤੁਸੀਂ ਠੀਕ ਹੈ ਅਤੇ ਥੋੜ੍ਹਾ ਜਲਦੀ ਕਰ ਦਿਓ ਕਿਉਂਕਿ ਸਾਨੂੰ ਜਲਦੀ ਹੈਗੀ ਆ ਗੈਸਟ ਆ ਕੇ ਬੈਠੇ ਹੋਏ ਨੇ ਠੀਕ ਹੈ ਓਕੇ ਓਕੇ ਸਰ ਥੈਂਕ ਯੂ